ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਸਨੀ ਰੈਸਟੋਰੈਂਟ ਤੋਂ ਲੰਚ ਮੰਗਵਾਇਆ ਸੀਗਾ ਅਤੇ ਲੰਚ ਜਿਹੜਾ ਹੈਗਾ ਉਹ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸਵਾਦ ਸੀਗਾ ਜਿਹਦੇ 'ਚ ਤੁਹਾਡੀਆਂ ਦੋ ਸਬਜ਼ੀਆਂ ਸੀਗੀਆਂ ਸ਼ਾਹੀ ਪਨੀਰ ਸੀਗਾ ਮਿਕਸ ਵੈੱਜ ਸੀਗੀ ਅਤੇ ਚਾਰ ਫੁਲਕੇ ਸੀਗੇ ਥੋੜ੍ਹੇ ਜਿਹੇ ਚੌਲ ਸੀਗੇ ਨਾਲ ਰਾਇਤਾ ਸੀਗਾ ਸਲਾਦ ਸੀਗਾ ਅਤੇ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈਗੀ ਆ ਹਰ ਵਾਰ ਦੀ ਤਰ੍ਹਾਂ ਉਹਦੀ ਕੁਆਂਟਿਟੀ ਅਤੇ ਜਿਹੜੀ ਕੁਆਲਿਟੀ ਹੈ ਉਹ ਅੱਛੀ ਸੀਗੀ ਅਤੇ ਜਿਹੜੀ ਡਿਲੀਵਰੀ ਹੈ ਉਹ ਵੀ ਮਿੱਥੇ ਸਮੇਂ ਦੇ ਵਿੱਚ ਮੇਰੇ ਕੋਲ ਪਹੁੰਚ ਗਈ ਸੀਗੀ ਅਤੇ ਬਸ ਥੋੜ੍ਹਾ ਜਿਹਾ ਸਲਾਦ ਜਿਹੜਾ ਹੈਗਾ ਉਹ ਮੈਨੂੰ ਉਹਦੀ ਜਿਹੜੀ ਵਰਾਇਟੀ ਹੈ ਮਤਲਬ ਕੁਆਂਟਿਟੀ ਠੀਕ ਸੀਗੀ ਪਰ ਉਹ ਦੋ ਜਾਂ ਤਿੰਨ ਤਰ੍ਹਾਂ ਦਾ ਸੈਲਡ ਹੁੰਦਾ ਪਹਿਲਾਂ ਤੁਹਾਡਾ ਪਰ ਇਸ ਵਾਰ ਉਹ ਇੱਕ ਤਰ੍ਹਾਂ ਦਾ ਹੀ ਸੀਗਾ ਸੋ ਓਵਰਅੋਲ ਜਿਹੜੀ ਤੁਹਾਡੀ ਜਿਹੜੀ ਹੈਗੀ ਆ ਉਹ ਤੁਹਾਡਾ ਖਾਣਾ ਜਿਹੜਾ ਉਹ ਠੀਕ ਸੀਗਾ ਵਧੀਆ ਸੀਗਾ ਠੀਕ ਨਹੀਂ ਵਧੀਆ ਸੀਗਾ ਪਰ ਜਿਹੜੀ ਮੈਂ ਥੋੜ੍ਹੀ ਜਿਹੀ ਇੱਕ ਕਮੀ ਦੱਸੀ ਆ ਤੁਹਾਨੂੰ ਉਮੀਦ ਕਰਦਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਵੀ ਠੀਕ ਕਰੋਗੇ ਸਤਿ ਸ਼੍ਰੀ ਅਕਾਲ